ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਅੱਛਾ ਅੱਛਾ ਸਤਿੰਦਰ ਭਾਜੀ ਹੈਗੇ ਨੇ ਆਪਣੇ ਲੁਧਿਆਣਾ ਹਾਂਜੀ ਮੰਜੀ ਸਾਹਿਬ ਹਾਂਜੀ ਹਾਂਜੀ ਹਾਂਜੀ ਹੋਰ ਕਿਵੇਂ ਯਾਦ ਕੀਤਾ ਪਿਆਰਿਓ ਅੱਛਾ ਅੱਛਾ ਜੀ ਹਾਂਜੀ ਹਾਂਜੀ ਦਸਵੇਂ ਪਾਤਸ਼ਾਹ ਦੀ ਜਗ੍ਹਾ ਜੀ

ਇਹ ਗੁਰੂ ਸਾਹਿਬ ਜੀ ਆਏ ਸੀਗੇ ਜੀ ਇੱਥੇ ਚਰਨ ਕਮਲ ਸਾਹਿਬ ਜਦੋਂ ਆਪਣੇ ਇੱਥੇ ਇਤਿਹਾਸ ਕਾਫੀ ਵੱਡਾ ਜੀ ਚਰਨ ਕਮਲ ਸਾਹਿਬ ਦੇ ਨਾਲ ਮਾਛੀਵਾੜਾ ਇਹ ਪਤਾ ਹੋਊ ਤੁਸੀਂ ਸੁਣਿਆ ਹੋਊਗਾ ਇਲਾਕਾ ਹਾਂਜੀ ਇੱਥੇ ਤਾਂ ਇਤਿਹਾਸਿਕ ਇਤਿਹਾਸਿਕ ਗੁਰਦੁਆਰਾ ਸਾਹਿਬ ਹੈਗੇ ਨੇ ਜੀ ਪੰਜ ਛੇ ਨੇ ਹਾਂਜੀ ਹਾਂਜੀ ਇੱਥੇ ਚਰਨ ਕਮਲ ਸਾਹਿਬ ਗੁਰੂ ਸਾਹਿਬ ਆ ਕੇ ਬੈਠੇ ਸੀ ਨਾ ਪੇੜ ਦਾ ਸਰਾਹਾਣਾ ਲਗਾ ਕੇ ਹਾਂ ਜੀ ਚਮਕੌਰ ਦੀ ਗੜੀ ਤੋਂ ਬਾਅਦ ਇੱਥੇ ਆਏ ਸੀ ਨਾ ਹਾਂਜੀ ਹਾਂਜੀ ਇਹ ਅਸਲ ਨੇ ਉਹ ਸੀਗਾ ਜੀ ਆਪਣਾ ਬਾਗ ਸੀਗਾ ਗੁਲਾਬੇ ਪੰਜਾਬੇ ਦਾ ਜਿਹੜੇ ਸਥਾਨ 'ਤੇ ਹਾਂਜੀ ਹਾਂਜੀ ਹਾਂਜੀ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਹੈਗੀ ਆ ਜੀ ਮਤਲਬ ਸਰਾਵਾਂ ਨਹੀਂ ਹੈਗੀਆਂ ਜਾਨੀ ਜਗ੍ਹਾ ਹੈਗੀ ਆ ਕਮਰੇ ਮਿਲ ਜਾਣਗੇ ਕੋਈ ਨਾ ਜੀ ਨਹੀਂ ਨਹੀਂ ਨਹੀਂ ਜੀ ਫਰੀ ਨੇ ਪਹਿਲਾਂ ਹਾਂਜੀ ਤੁਸੀਂ ਆ ਜਾਇਓ ਕੋਈ ਨਾ ਜੀ ਹੈਗਾ ਹੈਗਾ ਹੈਗਾ ਜੀ ਗੁਰਦੁਆਰਾ ਸਾਹਿਬ ਕੋਲ ਬੈਂਕ ਵੀ ਹੈਗੇ ਅਤੇ ਹੋਰ ਵੀ ਇਤਿਹਾਸਿਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਗੁਰਦੁਆਰਾ ਚੁਬਾਰਾ ਸਾਹਿਬ ਹਾਂ ਭੱਠਾ ਸਾਹਿਬ ਕਿਰਪਾਨ ਭੇਟ ਹਾਂਜੀ ਹਾਂਜੀ ਇਹ ਆਪਣਾ ਜਿਹੜੀ ਰੋਪੜ ਵਾਲੀ ਨਹਿਰ ਆ ਹਾਂਜੀ ਕੋਈ ਨਾ ਕੋਈ ਨਾ ਜੀ ਦਾਸ ਕੋਈ ਨਾ ਕੋਈ ਨਾ ਦਾਸ ਦਾ ਨਾਂ ਲੈ ਦਿਓ ਜੀ ਆ ਜਾਵਾਂਗੇ ਜੀ ਅਸੀਂ ਜ਼ਰੂਰ ਜ਼ਰੂਰ ਜੀ ਡਿਊਟੀ ਲਾਵਾਂਗੇ ਸਿੰਘ ਦੀ ਇੱਕ ਦੀ ਤੁਹਾਡੇ ਨਾਲ ਰਹੂ ਹਾਂਜੀ ਹਾਂਜੀ ਨਹੀਂ ਨਹੀਂ ਹਾਂਜੀ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਉੱਪਰ ਪਰੇ ਨੇ ਵੀ ਹਾਂਜੀ ਥੱਲੇ ਵੀ ਹੈਗੇ ਨੇ ਇੱਧਰ ਹਾਂਜੀ ਹਾਂਜੀ ਦੇਖੋ ਜੀ ਖਾਣ ਦਾ ਗੁਰੂ ਘਰ ਕੋਈ ਘਾਟਾ ਬਾਹ ਸਾਡਾ ਕਾਹਦਾ ਇਹ ਤਾਂ ਗੁਰੂ ਨੇ ਕਰਨਾ ਹਾਂਜੀ ਹਾਂਜੀ ਅੱਛਾ ਜੀ ਜ਼ਰੂਰ ਜੀ

ਜ਼ਰੂਰ ਜ਼ਰੂਰ ਜੀ ਜ਼ਰੂਰ ਜ਼ਰੂਰ ਜ਼ਰੂਰ ਜੀ ਹੋਰ ਪਰਿਵਾਰ ਠੀਕ ਠਾਕ ਜੀ ਹਾਂਜੀ ਹਾਂਜੀ ਮਾਛੀਵਾੜਾ ਇੱਥੇ ਸ਼ਹਿਰ ਆ ਕਾਫੀ ਹਾਂ ਹਾਂ ਅੱਗੇ ਵੀ ਤੁਸੀਂ ਅਨੰਦਪੁਰ ਸਾਹਿਬ ਨੂੰ ਜਾਣਾ ਇੱਥੋਂ ਹਾਂਜੀ ਜੀ ਚਮਕੌਰ ਸਾਹਿਬ ਜਲੰਧਰ ਤੋਂ ਤੁਸੀਂ ਵਾਇਆ ਮੈਪ ਲਾ ਲਿਓ ਨਾ ਜਲੰਧਰ ਤੋਂ ਲੁਧਿਆਣੇ ਚਾਹੇ ਓ ਰਾਹੋਂ ਉਰਾਂ ਚੰਡੀਗੜ੍ਹ ਨੂੰ ਆ ਜਾਇਓ ਹਾਂ ਉੱਥੋਂ ਹਾਂ ਸਮਰਾਲੇ ਤੋਂ ਟਰਨ ਲੈ ਲੈਣਾ ਮਾਛੀਵਾੜੇ ਨੂੰ ਹਾਂ ਚਾਹੇ ਉੱਥੋਂ ਸਮਰਾਲੇ ਨਹਿਰੋ ਨਹਿਰ ਹੋ ਜਾਇਓ ਗੜੀ ਦੇ ਪੁੱਲ ਤੋਂ ਮੁੜ ਜਾਣਾ ਅੱਗੇ ਨੇੜੇ ਤੇੜੇ ਵੀ ਹੈਗੇ ਨੇ ਹਾਂ ਜੀ

ਜ਼ਰੂਰ ਕਰਾਂਗੇ ਜੀ ਜ਼ਰੂਰ ਤੁਸੀਂ ਆਓ ਚੰਗਾ ਜੀ ਫਿਰ ਕੋਈ ਨਾ ਹਾਂਜੀ ਹਾਂਜੀ ਸਤਿੰਦਰ ਭਾਜੀ ਇੱਥਥੇ ਕੀਰਤਨ ਕਰਕੇ ਜਾਂਦੇ ਰਹੇ ਨੇ ਹਾਂਜੀ ਹਾਂਜੀ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ